ਪੰਜਾਬ ਵਿੱਚ ਜਿਹੜਾ ਮੇਨ ਅੱਜ ਮੌਤ ਦਾ ਕਾਰਨ ਬਣ ਰਿਹਾ ਏ ਉਹ ਹੈ ਜੀ ਜਿਹੜਾ ਨਸ਼ਾ ਇੱਕ ਜਿਹੜਾ ਨਸ਼ਾ ਇਹਨੇ ਅੱਜ ਦੀ ਜਿਹੜੀ ਜੈਨਰੇਸ਼ਨ ਆ ਜਿਹੜਾ ਅੱਜ ਦਾ ਯੂਥ ਹੈ ਉਹਨੂੰ ਖਤਮ ਕਰਨ 'ਤੇ ਤੁਰੀ ਹੋਈ ਆ ਠੀਕ ਹੈ ਇਹਦਾ ਜਿਹੜਾ ਹੱਲ ਹੈ ਉਹ ਵੀ ਸਾਨੂੰ ਹੀ ਨਿਕਾਲਣਾ ਪੈਣਾ ਏ ਸਰਕਾਰਾਂ ਨੂੰ ਅਸੀਂ ਕਹੀ ਜਾ ਰਹੇ ਹਾਂ ਬਲੇਂਮ ਦਈ ਜਾ ਰਹੇ ਜੀ ਸਰਕਾਰਾਂ ਇਹ ਕੁਛ ਕਰ ਰਹੀਆਂ ਏ ਠੀਕ ਹੈ ਸਰਕਾਰਾਂ ਦੇ ਨਾਲ ਨਾਲ ਸਾਨੂੰ ਵੀ ਉਸ ਚੀਜ਼ ਨੂੰ ਹੱਲ ਕਰਨ ਲਈ ਕੀ ਹੈ ਕਿ ਅੱਗੇ ਪਹਿਲ ਕਦਮੀ ਕਰਨੀ ਚਾਹੀਦੀ ਹੈ ਠੀਕ ਹੈ ਜੀ ਕਿ ਅਗਰ ਅਸੀਂ ਕਿਤੇ ਵੀ ਦੇਖਦੇ ਹਾਂ ਕਿ ਕੋਈ ਨਸ਼ਾ ਕਿਤੇ ਵੀ ਵਿਕਦਾ ਦਿਖ ਰਿਹਾ ਏ ਜਾਂ ਕਿਤੇ ਵੀ ਕੋਈ ਤੁਹਾਨੂੰ ਨਸ਼ੇੜੀ ਦਿਖ ਰਿਹਾ ਏ ਤਾਂ ਤੁਹਾਨੂੰ ਕੀ ਹੈ ਇਹਦੀ ਜਿਹੜੀ ਇਤਲਾਹ ਏ ਉਹ ਪੁਲਿਸ ਠਾਣੇ ਦੇਣੀ ਚਾਹੀਦੀ ਆ ਠੀਕ ਹੈ ਜਾਂ ਉਹ ਫਿਰ ਉਹ ਜਿਹੜੇ ਬੱਚਾ ਕੋਈ ਤੁਹਾਨੂੰ ਦਿਖ ਰਿਹਾ ਏ ਕੋਈ ਕਰਾਇਮ ਇੱਦਾਂ ਦਾ ਗਲਤ ਕਰਦਾ ਤਾਂ ਉਹਦੇ ਪੇਰੈਂਟਸ ਜਿਹੜੇ ਮਾਤਾ ਪਿਤਾ ਏ ਉਹਨੂੰ ਵੀ ਜਿਹੜੀ ਕੀ ਹੈ ਇਸ ਚੀਜ਼ ਦੀ ਇਤਲਾਹ ਦੇਣੀ ਚਾਹੀਦੀ ਹੈ ਤਾਂ ਕਿ ਜਿਹੜਾ ਉਹ ਹੈ ਯੂਥ ਹੈ ਇਹਨੂੰ ਅਸੀਂ ਬਚਾ ਸਕੀਏ ਨਸ਼ਿਆਂ ਤੋਂ